ਸ਼ਹਿਰੀਕਰਨ ਹੋਣ ਕਾਰਨ ਮੋਹਾਲੀ ਜ਼ਿਲ੍ਹੇ 'ਚ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ ਪਿਛਲੇ ਸਾਲਾਂ ਦੌਰਾਨ ਮੋਹਾਲੀ ਜ਼ਿਲ੍ਹੇ ਦੇ ਹਾਲਾਤ ਬਹੁਤ ਖਸਤਾ ਸੀ ਪ੍ਰੰਤੂ ਚੰਡੀਗੜ੍ਹ ਨੇੜੇ ਹੋਣ ਕਾਰਨ ਬਹੁਤ ਜਲਦੀ ਸੁਧਾਰ ਹੋਇਆ ਅਤੇ ਹੁਣ ਲੋਕਾਂ ਦੇ ਰਹਿਣ ਸਹਿਣ ਅਤੇ ਹੋਰ ਬਹੁਤ ਸਾਰੇ ਕੰਮਾਂ ਕਾਰਾਂ ਦੇ ਪ੍ਰਭਾਵ ਪਿਆ ਅਤੇ ਹਰ ਇੱਕ ਪੱਖ ਤੋਂ ਮੋਹਾਲੀ ਸ਼ਹਿਰ ਬਹੁਤ ਚੰਗਾ ਹੈ